ਮੇਰਾ ਫ਼ੋਨ ਟੁੱਟ ਗਿਆ ਸੀ ਮੈਂ ਕੁਝ ਦਿਨਾਂ ਤੋਂ ਸੋਚ ਰਹੀ ਸੀ ਫੋਨ ਨਵਾਂ ਲੈਣ ਲਈ ਪਰ ਅੱਜ ਕੱਲ੍ਹ ਫੋਨ ਐਨੇ ਜ਼ਿਆਦਾ ਮਹਿੰਗੇ ਨੇ ਇਸ ਲਈ ਮੈਂ ਇੱਕ ਦੋ ਮਹੀਨਾ ਇੱਦਾਂ ਹੀ ਸਾਰ ਲਿਆ ਪਰ ਫਿਰ ਮੈਨੂੰ ਮੇਰੀ ਪੜ੍ਹਾਈ ਅਤੇ ਹੋਰ ਕੰਮਾਂ ਵਿੱਚ ਫੋਨ ਦੀ ਬਹੁਤ ਜ਼ਿਆਦਾ ਲੋੜ ਪਈ ਫਿਰ ਮੈਨੂੰ ਆਨਲਾਈਨ ਵੈੱਬਸਾਇਟ ਦੇ ਵਿੱਚ ਆਫਰ ਦਿੱਖੀ ਤੀਹ ਚਾਲ਼ੀ ਪਰਸੈਂਟ ਫੋਨ ਦੇ ਵਿੱਚ ਫਿਰ ਮੈਂ ਆਪਣੇ ਮਾਪਿਆਂ ਨੂੰ ਦੱਸਿਆ ਤਾਂ ਉਹਨਾਂ ਨੇ ਕਿਹਾ ਮੈਨੂੰ ਵੀ ਕੋਈ ਵੀ ਸਸਤੀ ਚੀਜ਼ ਵਧੀਆ ਨਹੀਂ ਹੁੰਦੀ ਹੈ ਪਰ ਫਿਰ ਵੀ ਮੈਂ ਜ਼ਿੱਦ ਕਰਕੇ ਆਪਣਾ ਫੋਨ ਆਰਡਰ ਕਰ ਦਿੱਤਾ ਫਿਰ ਜਦੋਂ ਮੇਰਾ ਫੋਨ ਆਇਆ ਤਾਂ ਮੈਂ ਉਸ ਨੂੰ ਦੇਖ ਕੇ ਬਹੁਤ ਹੈਰਾਨ ਹੋਈ ਇੰਨਾ ਜ਼ਿਆਦਾ ਵਧੀਆ ਫੋਨ ਸੀ ਉਸਦੀ ਕਵਾਲੀਟੀ ਡਿਸ਼ਪਲੇਅ ਬਹੁਤ ਜ਼ਿਆਦਾ ਵਧੀਆ ਸੀ ਅਤੇ ਨਾਲੇ ਉਹਦੇ ਨਾਲ ਹੈੱਡਫੋਨ ਵੀ ਫ਼ਰੀ ਆਏ ਅਤੇ ਪੰਜ ਹਜ਼ਾਰ ਐੱਮ ਐੱਸ ਬੈਟਰੀ ਵੀ ਸੀ ਅਤੇ ਫੋਨ ਦਾ ਕੈਮਰਾ ਵੀ ਬਹੁਤ ਜ਼ਿਆਦਾ ਵਧੀਆ ਸੀ ਮੈਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਮੇਰੇ ਫੋਨ ਵਿੱਚ ਕੋਈ ਵੀ ਖਰਾਬੀ ਨਹੀਂ ਆਈ ਅਤੇ ਮੈਨੂੰ ਲੱਗਿਆ ਵੀ ਆਨਲਾਈਨ ਆਰਡਰ ਕਰਕੇ ਵੀ ਮੇਰਾ ਫੋਨ ਇੱਕ ਦੋ ਮਹੀਨੇ ਤੱਕ ਵਧੀਆ ਚੱਲੇਗਾ ਫਿਰ ਖਰਾਬ ਹੋਜੂਗਾ ਪਰ ਏਦਾਂ ਕੁਛ ਨਹੀਂ ਹੋਇਆ ਮੇਰਾ ਫੋਨ ਇੱਕ ਦੋ ਮਹੀਨੇ ਬਾਅਦ ਵੀ ਬਹੁਤ ਜ਼ਿਆਦਾ ਵਧੀਆ ਚੱਲਿਆ ਅਤੇ ਮੈਂ ਆਪਣੇ ਫੋਨ ਦੇ ਲਈ ਬਹੁਤ ਜ਼ਿਆਦਾ ਆਪਣੇ ਪਰੋਡਕਟ ਲਈ ਸੈਟਸਫਾਈ ਹਾਂ ਅਤੇ ਅੱਗੇ ਵੀ ਮੈਨੂੰ ਇੱਦਾਂ ਹ ਹੀ ਪਰੋਡਕਟ ਮਿਲੇ